ਭਾਰਤ ਤੇ ਤਿਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਜਾਤੀਆਂ ਜਮਾਤਾਂ ਧਾਰਮਿਕ ਆਰਥਿਕ ਅਤੇ ਸੱਭਿਆਚਾਰਿਕ ਸਮੱਸਿਆਵਾਂ ਹਨ ਹਰ ਸਿਆਸੀ ਪਾਰਟੀ ਨੂੰ ਚੰਗਾ ਪ੍ਰਦਰਸ਼ਨ ਤੇ ਮੁੱਦਿਆਂ ਤੋਂ ਗਾਂਹ ਜਾਂਦੇ ਇੱਕ ਅਜਿਹੇ ਵਿਚਾਰ ਧਾਰਨਾ ਅਪਣਾਉਣੀ ਪੈਂਦੀ ਹੈ ਜਿਸ ਰਾਹੀਂ ਉਹਨਾਂ ਨੂੰ ਆਪਣੇ ਵੋਟਰਾਂ ਨੂੰ ਇਹ ਦੱਸਣ ਦੱਸ ਸਕਣ ਕਿ ਸਮਾਜ ਵਿੱਚ ਮੌਜੂਦ ਵੱਖ ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਤੀ ਉਹਨਾਂ ਦੀ ਪਹੁੰਚ ਕੀ ਹੈ ਰਾਸ਼ਟਰੀ ਅਤੇ ਭਾਰਤੀ ਜਨਤਾ ਪਾਰਟੀ ਅਨੁਸਾਰ ਸਮੱਸਿਆਵਾਂ ਦਾ ਹੱਲ ਹਿੰਦੂਤਾ ਦੇ ਸਵਾਸਟਰ ਵਿੱਚ ਪਿਆ ਹੈ ਕਾਂਗਰਸ ਤੇ ਹੋਰ ਕੇਂਦਰੀਕ ਵਿਦਿਆ ਪਾਰਟੀਆਂ ਅਨੁਸਾਰ ਉਤਰਵਾਦੀ ਅਤੇ ਧਰਮਸਲ ਵਿੱਚ ਪਾਉਂਦੇ ਹਨ ਖੱਬੇ ਪੱਖ ਧਿਰਾਂ ਨੂੰ ਜਮਾਤਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਂਦੀਆਂ ਹਨ ਅਤੇ ਬੇਹਥੀ ਸਮਾਜਿਕ ਪਾਰਟੀਆਂ ਸਮਾਜਵਾਦੀ ਪਾਰਟੀਆਂ ਰਾਸ਼ਟਰੀ ਜਨਤਾ ਦਲ ਆਦਿ ਜਾਤੀਵਾਦ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰ ਅਤੇ ਸਿੱਖ ਘੱਟ ਗਿਣਤੀ ਦੀ ਪ੍ਰਤੀਨਿਧੀ ਹੈ ਉਨੀ ਸੋ ਸੰਤਾਲੀ ਤੋਂ ਬਾਅਦ ਪੰਜਾਬ ਵਿੱਚ ਤਿੰਨ ਮੁੱਖ ਸਿਆਸੀ ਧਿਰਾਂ ਸਾਹਮਣੇ ਆਈਆਂ ਹਨ ਇੰਡੀਅਨ ਨੈਸ਼ਨਲ ਕਾਂਗਰਸੀ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਆਫ ਇੰਡੀਆ ਵਾਤਾਵਰਨ ਸਮੇਤ ਸ਼੍ਰੋਮਣੀ ਅਕਾਲੀ ਦਲ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਧਿਰਾਂ ਹਨ ਕੁਝ ਪਾਰਟੀਆਂ ਅਜਿਹੀਆਂ ਹਨ ਜੋ ਪੰਜਾਬ ਮੁਕਾਬਲੇ ਭਾਜਪਾ ਦਰਮਿਆਨ ਹੀ ਹੁੰਦੀਆਂ ਹਨ ਇਹਨਾਂ ਵਿੱਚ ਆਮ ਤੌਰ ਤੇ ਸਮਾਨ ਅਤੇ ਵਿੱਦਿਅਕ ਸਮੱਸਿਆਵਾਂ ਕਾਰਨ ਤੀਸਰੇ ਬਦਲ ਦੀ ਸਮੱਸਿਆ ਹੋਰ ਵੀ ਦੇਖੀਆਂ ਜਾ ਰਹੀਆਂ ਹਨ